ਭੰਗੜਾ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਅਤੇ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਇਹ ਨਾ ਸਿਰਫ ਇੱਕ ਨਾਚ ਹੈ ਸਗੋਂ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਤੀਕ ਵੀ ਹੈ ਆਓ ਦੇਖੀਏ ਕਿ ਭੰਗੜਾ ਪੰਜਾਬੀ ਸੱਭਿਆਚਾਰ ਵਿੱਚ ਕਿਉਂ ਇੰਨਾ ਮਹੱਤਵਪੂਰਨ ਹੈ ਅਤੇ ਸਮੇਂ ਦੇ ਨਾਲ ਕਿਵੇਂ ਪੰਜਾਬੀ ਤਿਉਹਾਰਾਂ ਅਨਿੱਖੜਵਾਂ ਅੰਗ ਬਣ ਗਿਆ ਹੈ ਭੰਗੜੇ ਦੀ ਮਹੱਤਤਾ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸ਼ਾਹ ਦੇ ਜੀਵਨ ਦੇ ਜਸ਼ਨ ਦਾ ਪ੍ਰਗਟਾਵਾ ਅਤੇ ਇਹ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਅਤੇ ਖੁਸ਼ੀ ਮਨਾਉਣ ਦਾ ਇੱਕ ਤਰੀਕਾ ਸੀ ਸੱਭਿਆਚਾਰਕ ਪਛਾਣ ਭੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਇਹ ਪੰਜਾਬੀਆਂ ਦੀ ਮਿਹਨਤ ਲਚਕੀਲੇਪਨ ਅਤੇ ਖੁਸ਼ੀ ਦਾ ਪ੍ਰਤੀਕ ਹੈ ਸਮਾਜਿਕ ਬੰਧਨ ਭੰਗੜਾ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਸਮਾਜਿਕ ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਤਿਉਹਾਰਾਂ ਅਤੇ ਵਿਆਹਾਂ ਵਿੱਚ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ ਸਰੀਰ ਅਤੇ ਮਨ ਲਈ ਫਾਇਦੇਮੰਦ ਭੰਗੜਾ ਇੱਕ ਸਰੀਰਕ ਗਤੀਵਿਧੀ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਅਤੇ ਮਨ ਨੂੰ ਖੁਸ਼ੀ ਰੱਖੋ ਖੁਸ਼ ਰੱਖਦੀ ਹੈ ਪੰਜਾਬੀ ਸੰਗੀਤ ਦਾ ਪ੍ਰਚਾਰ ਭੰਗੜਾ ਪੰਜਾਬੀ ਸੰਗੀਤ ਨੂੰ ਦੁਨੀਆਂ ਭਰ ਪ੍ਰਸਿੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਭੰਗੜਾ ਅਤੇ ਪੰਜਾਬੀ ਤਿਉਹਾਰ ਭੰਗੜਾ ਹੁਣ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਲੋਕ ਵਿਸਾਖੀ ਦੀਵਾਲੀ ਲੋਹੜੀ ਅਤੇ ਹੋਰ ਤਿਉਹਾਰਾਂ ਦੌਰਾਨ ਭੰਗੜੇ ਦਾ ਆਨੰਦ ਲੈਂਦੇ ਹਨ ਭੰਗੜੇ ਨੇ ਨਾ ਸਿਰਫ ਪੰਜਾਬ ਵਿੱਚ ਸਗੋਂ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਇਕੱਠਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸਿੱਟਾ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਮੋਲ ਖਜ਼ਾਨਾ ਹੈ ਇਹ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਤੀਕ ਭੰਗੜੇ ਨੇ ਸਮੇਂ ਦੇ ਨਾਲ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਕੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ